ਮੇਰੀ ਪਸੰਦੀਦਾ ਜੋ ਨੌਕਰੀ ਆ ਉਹ ਟੀਚਿੰਗ ਦੀ ਨੌਕਰੀ ਆ ਅਤੇ ਮੈਨੂੰ ਟੀਚਿੰਗ ਕਰਨਾ ਮਤਲਬ ਪੜ੍ਹਾਉਣਾ ਵਧੀਆ ਲੱਗਦਾ ਆ ਮੇਰੇ ਹਿਸਾਬ ਨਾਲ਼ ਮੈਨੂੰ ਇਹ ਆ ਕਿ ਟੀਚਿੰਗ ਲਾਈਨ ਦੇ ਵਿੱਚ ਸਾਨੂੰ ਮੈਂਟਲੀ ਜਿਹੜਾ ਪੀਸ ਆ ਉਹ ਬਹੁਤ ਜ਼ਿਆਦਾ ਮਿਲਦਾ ਕਿਉਂਕਿ ਬੱਚਿਆਂ ਦੇ ਨਾਲ਼ ਰਹਿ ਕੇ ਮਨ ਖੁਸ਼ ਹੁੰਦਾ ਅਤੇ ਮੈਨੂੰ ਬੱਚਿਆਂ ਨੂੰ ਪੜ੍ਹਾਉਣਾ ਜੋ ਵਧੀਆ ਲੱਗਦਾ ਆ ਮੇਰਾ ਮਨ ਇਹ ਹੈ ਕਿ ਮੈਂ ਟੀਚਿੰਗ ਲਾਈਨ ਦੇ ਵਿੱਚ ਜਾ ਕੇ ਜੋ ਛੋਟੇ ਬੱਚੇ ਆ ਉਹਨਾਂ ਦਾ ਅਸੀਂ ਭਵਿੱਖ ਜਿਹੜਾ ਹੈਗਾ ਉਹ ਅਸੀਂ ਸਾਡੇ ਹੱਥ ਵਿੱਚ ਹੁੰਦਾ ਆ ਅਤੇ ਮੈਂ ਵਧੀਆ ਟੀਚਰ ਬਣਨਾ ਚਾਹੁੰਦੀ ਹਾਂ ਕਿ ਮੈਂ ਆਪਣੇ ਬੱਚੇ ਹੈ ਜਿਹੜੇ ਉਹ ਉਹਨਾਂ ਦੀ ਮੈਂਟੇ ਮੈਂਟਲ ਐਬਿਲਟੀ ਆ ਜਿਹੜੇ ਉਹ ਅ ਅੱਛੀ ਕਰ ਸਕਾਂ ਅਤੇ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਕਰ ਸਕਾਂ ਅਤੇ ਜਿਹੜਾ ਹੀ ਆਪਣੀ ਟੀਚਿੰਗ ਦੀ ਨੌਕਰੀ ਆ ਉਹ ਆਪਣੇ ਰਾਜਨੀਤਿਕ ਦਬਾਅ ਤੋਂ ਜਿਹੜੀ ਰਹਿਤ ਹੁੰਦੀ ਆ ਅਤੇ ਬਹੁਤ ਸਕੂਨ ਭਰੀ ਜੋ ਨੌਕਰੀ ਆ ਅਤੇ ਮੈਨੂੰ ਮੇਰੀ ਨੌਕਰੀ ਜੋ ਟੀਚਿੰਗ ਲਾਈਨ ਆ ਮੈਨੂੰ ਉਹ ਪਸੰਦ ਹੈ